ਅੱਜ ਕੱਲ੍ਹ ਲੋਕ ਏ ਸਾਰੇ ਡਾਂਸ ਸਿੱਖਣਾ ਪਸੰਦ ਕਰਦੇ ਆ ਲੇਕਿਨ ਜ਼ਿਆਦਾਤਰ ਲੋਕ ਭੰਗੜੇ ਨੂੰ ਲੈ ਕੇ ਬੜੇ ਵੀ ਖੁਸ਼ ਹੁੰਦੇ ਆ ਬੱਚਿਆਂ ਨੂੰ ਸਿਖਾਉਂਦੇ ਆ ਅਤੇ ਜ਼ਿਆਦਾਤਰ ਬੱਚੇ ਭੰਗ ਪੀ ਭੰਗੜਾ ਗਿੱਧਾ ਕੁੜੀਆਂ ਪੀ ਮੁੰਡਿਆਂ ਵਾਲਾ ਭੰਗੜਾ ਜਿਵੇਂ ਉਹਨਾਂ ਨੂੰ ਲੈ ਕੇ ਬੜੇ ਖੁਸ਼ ਰਹਿੰਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਕੁੜੀਆਂ ਵੀ ਉਹੀ ਸਟੈਪ ਮਾਰ ਕੇ ਖੁਸ਼ ਨੇ ਵਧੀਆ ਕਰਦੇ ਆ ਬੱਚੇ ਸਕੂਲਾਂ 'ਚ ਸੱਭਿਆਚਾਰ ਪ੍ਰੋਗਰਾਮ ਜਿਹੜੇ ਅੱਜ ਕੱਲ੍ਹ ਚੱਲਦੇ ਉਹਨਾਂ 'ਚ ਵੀ ਬੱਚੇ ਹੀ ਵੀ ਪ੍ਰੋਪ ਹਿੱਸਾ ਲੈਂਦੇ ਆ ਅਤੇ ਜੇ ਤੁਸੀਂ ਵੇਖੋ ਵੀ ਬਾਹਰਲੀਆਂ ਕੰਟਰੀਆਂ ਵਿੱਚ ਵੀ ਲੋਕ ਆਪਣੇ ਬੱਚਿਆਂ ਨੂੰ ਭੰਗੜੇ ਦੇ ਨਾਲ ਜੋੜ ਕੇ ਬੜੇ ਖੁਸ਼ ਰਹਿੰਦੇ ਆ ਅਤੇ ਇਸ ਕਰਕੇ ਇਹ ਇਸ ਲਈ ਮੈਨੂੰ ਇਹ ਲੱਗਦਾ ਕਿ ਜ਼ਿਆਦਾਤਰ ਉਹ ਭੰਗੜੇ ਨੂੰ ਹੀ ਅੱਗੇ ਲਿਆਉਣਾ ਚਾਹੁੰਦੇ ਆ ਉਹਦੇ ਨਾਲ ਉਹਨਾਂ ਨੂੰ ਵੀ ਆਪਣੇ ਇ ਇੱਕ ਤਾਂ ਆਪਣੇ ਕਲਚਰ ਨਾਲ ਜੋੜਦੇ ਆ ਅਤੇ ਗਿੱਧਾ ਭੰਗੜਾ ਬੱਚਿਆਂ ਨੂੰ ਅੱਜ ਕੱਲ੍ਹ ਆਮ ਹੀ ਗੱਲ ਹੋ ਗਈ ਆ ਕਿ ਉਹ ਭੰਗੜਾ ਲੈ ਕੇ ਅੱਗੇ ਤੁਰਦੇ ਆ ਅਤੇ ਲੇਕਿਨ ਜਿੱਦਾਂ ਸਾਰੇ ਮਾਂ ਪਿਓ ਨੂੰ ਇਹ ਹੁੰਦਾ ਕਿ ਬੱਚੇ ਆਪਣੇ ਆਪਣੇ ਕਲਚਰ ਨਾਲ ਜੁੜੇ ਰਹਿਣ ਦੂਰ ਨਾ ਕਿਤੇ ਜਾਣ ਅੰਗਰੇਜ਼ੀ ਡਾਂਸ ਕਰਦੇ ਜ਼ਰੂਰ ਵਾ ਪਰ ਉਹ ਇੱਕ ਇੰਜੋਇਮੈਂਟ ਲਈ ਕਰਦੇ ਆ ਕਿ ਜ਼ਿਆਦਾਤਰ ਉਹਨਾਂ ਨੂੰ ਭੰਗੜਾ ਹੀ ਪਸੰਦ ਵਾ ਅਤੇ ਉਹ ਭੰਗੜਾ ਹੀ ਕਰਨਾ ਚਾਹੁੰਦੇ ਸਾਰੇ